ਮੇਰੇ ਲਈ ਬੈਂਕਿੰਗ ਜਿਹੜੀ ਹੈ ਉਹ ਇੰਟਰਨੈਟ ਬੈਂਕਿੰਗ ਮੈਂ ਸਭ ਤੋਂ ਜ਼ਿਆਦਾ ਪਸੰਦ ਕਰਦਾ ਹਾਂ ਕਿਉਂਕਿ ਇਹਦੇ ਵਿੱਚ ਤੁਹਾਡਾ ਟਾਈਮ ਸਮਾਂ ਬਹੁਤ ਬਚਦਾ ਹੈ ਜੇ ਅਸੀਂ ਬੈਂਕਾਂ 'ਚ ਜਾਂਦੇ ਹਾਂ ਉੱਥੇ ਲੈਨਾਂ 'ਚ ਲੱਗਦੇ ਹਾਂ ਤਾਂ ਸਾਡੇ ਦੋ ਘੰਟੇ ਡੇਢ ਘੰਟਾ ਜਾਂ ਇੱਕ ਘੰਟਾ ਆਰਾਮ ਨਾਲ ਉੱਥੇ ਲੱਗ ਜਾਂਦਾ ਹੈ ਅਤੇ ਤੁਸੀਂ ਆਪਣੇ ਇੰਨੇ ਬਿਜ਼ੀ ਸ਼ੈਡਿਊਲ 'ਚੋਂ